ਅੱਜ ਦੇ ਸਮੇਂ 'ਤੇ ਚਿੰਤਾ ਇੱਕ ਅਜਿਹੀ ਬਿਮਾਰੀ ਬਣ ਗਈ ਹੈ ਜਿਹਦੇ ਕਰਕੇ ਲੋਕ ਬਹੁਤ ਹੀ ਦੁਖੀ ਨਿਰਾਸ਼ ਰਹਿੰਦੇ ਹਨ ਲੋਕ ਚਿੰਤਾ ਤੋਂ ਬਚਣ ਲਈ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਗਾਉਂਦੇ ਹਨ ਨੱਚਦੇ ਹਨ ਬਾਹਰ ਅੰਦਰ ਜਾਂਦੇ ਹਨ ਅਤੇ ਸਾਨੂੰ ਚਾਹੀਦਾ ਵੀ ਹੈ ਕਿ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖੀਏ ਜੇ ਅਸੀਂ ਅੱਜ ਆਪਣੇ ਮਨ ਨੂੰ ਸ਼ਾਂਤ ਰੱਖਾਂਗੇ ਤਾਂ ਕੱਲ ਅਸੀਂ ਸੌ ਬਿਮਾਰੀਆਂ ਤੋਂ ਦੂਰ ਰਹਾਂਗੇ ਜੇ ਕੋਈ ਇਨਸਾਨ ਗਾਉਣ ਦਾ ਚਾਹਵਾਨ ਹੈ ਤਾਂ ਉਸ ਨੂੰ ਸਰ ਸਭ ਤੋਂ ਪਹਿਲਾਂ ਆਪਣੀ ਝਿਜਕ ਨੂੰ ਦੂਰ ਕਰਨਾ ਚਾਹੀਦਾ ਹੈ ਕੁਝ ਲੋਕ ਝਿਜਕਦੇ ਕਰਕੇ ਵੀ ਨਹੀਂ ਗਾਉਂਦੇ ਲੋਕਾਂ ਦੇ ਸਾਹਮਣੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਜੇ ਕੋਈ ਗਾਣਾ ਚਾਹੁੰਦਾ ਹੈ ਅਤੇ ਅਸੀਂ ਉਹਨੂੰ ਆ ਗਾਉਣ ਲਈ ਉਤਸੁਕ ਕਰੀਏ ਕਿ ਹਾਂਜੀ ਤੁਸੀਂ ਗਾ ਸਕਦੇ ਹੋ ਫਿਰ ਉਸ ਤੋਂ ਬਾਅਦ ਲੋਕ ਹੌਲੀ ਹੌਲੀ ਆਪਣੇ ਘਰਾਂ ਵਿੱਚ ਹੋਣ ਵਾਲੇ ਛੋਟੇ ਮੋਟੇ ਫੰਕਸ਼ਨਸ ਪਾਰਟੀਜ਼ ਦੇ ਵਿੱਚ ਤੁਸੀਂ ਗਾ ਸਕਦੇ ਹੋ ਥੋੜ੍ਹਾ ਰਿਆਜ਼ ਕਰ ਸਕਦੇ ਹੋ ਕੁਛ ਅੱਛੇ ਸਿੰਗਰਸ ਦੇ ਤੁਸੀਂ ਸੰਗੀਤਕਾਰਾਂ ਦੇ ਗੀਤ ਸੁਣ ਸਕਦੇ ਹੋ ਇਜ਼ੀ ਗੀਤ ਨੂੰ ਸੁਣ ਕੇ ਤੁਸੀਂ ਉਸ ਦੀ ਉਸ ਨੂੰ ਦੁਬਾਰਾ ਦੁਹਰਾ ਸਕਦੇ ਹੋ ਤੁਸੀਂ ਮਨ ਦੇ ਵਿੱਚ ਗੁਣਗੁਣਾ ਸਕਦੇ ਹੋ ਤਾਂ ਕਿ ਤੁਸੀਂ ਹੌਲੀ ਹੌਲੀ ਹੌਲੀ ਹੌਲੀ ਨਿਖਰ ਸਕੋ ਅਤੇ ਇਹ ਤੁਹਾਨੂੰ ਆਪਣਾ ਇੱਕ ਅੱਛਾ ਗੁਰੂ ਬਣਾਉਣਾ ਚਾਹੀਦਾ ਹੈ ਜੋ ਤੁਹਾਨੂੰ ਸਮੇਂ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਸਿਖਾ ਸਕੇ ਕਿ ਕਿਹੜੀ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਗਾ ਸਕਦੇ ਹੋ ਜਿੱਦਾਂ ਜਿੱਦਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਸ਼ੁਰੂ ਕਰੋਗੇ ਤੁਹਾਨੂੰ ਆਪਣੇ ਆਪ ਆਪਣੇ ਵਿੱਚ ਇੱਕ ਹੌਸਲਾ ਅਫਜ਼ਾਈ ਮਿਲੇਗੀ ਤੁਸੀਂ ਬਾਹਰ ਅੰਦਰ ਜਾ ਕੇ ਗਾ ਸਕੋਗੇ ਆਪਣੇ ਦੋਸਤਾਂ ਨਾਲ ਬੈਠ ਕੇ ਤੁਸੀਂ ਕੋਈ ਗੀਤ ਗੁਣਗੁਣਾਓਂਗੇ ਚਾਰ ਲੋਕ ਜਦੋਂ ਸੁਣਦੇ ਨੇ ਤਾਂ ਉਦੋਂ ਉਹਨਾਂ ਨੂੰ ਵੀ ਵਧੀਆ ਲੱਗਦਾ ਹੈ ਕਿ ਕਿਸੇ ਨੇ ਜੇ ਇੰਨਾ ਵਧੀਆ ਗਾਇਆ ਅਤੇ ਉਹਨੂੰ ਹੋਰ ਹੌਸਲਾ ਦਿੱਤਾ ਜਾਵੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਬੰਦਾ ਜਦੋਂ ਵੀ ਗਾਉਣ ਦਾ ਇੱਛੁਕ ਹੈ ਤਾਂ ਉਹਨੂੰ ਗਾ ਲੈਣਾ ਚਾਹੀਦਾ ਹੈ ਆਪਣੀਆਂ ਇੱਛਾਵਾਂ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ ਧੰਨਵਾਦ